ਸਾਡੀ ਰਸੋਈ ਵਿੱਚ ਕਾਫ਼ੀ ਜ਼ਿਆਦਾ ਜ਼ਰੂਰੀ ਯੰਤਰ ਹਨ ਜਿਵੇਂ ਕਿ ਅਸੀਂ ਗੈਸ ਦੇਖ ਸਕਦੇ ਹਾਂ ਗੈਸ ਤੋਂ ਬਿਨਾਂ ਕਿਹੜਾ ਹੀ ਪਕਵਾਨ ਬਣੇਗਾ ਰੋਟੀ ਬਣਾਉਣ ਲਈ ਪਲਟ ਚਿਮਟਾ ਆਦਿ ਹੋਰ ਚੀਜ਼ਾਂ ਦੀ ਵੀ ਲੋੜ ਪੈਂਦੀ ਹੈ ਅਤੇ ਜੇ ਅਸੀਂ ਕੋਈ ਵੀ ਸਬਜ਼ੀ ਵਗੈਰਾ ਬਣਾਉਣੀ ਹੋਵੇ ਉਹ ਵੀ ਅਸੀਂ ਫਰਾਈ ਪੈਨ ਚਿਮਟਾ ਉਹਨਾਂ ਸਭ ਚੀਜ਼ਾਂ ਨਾਲ ਹੀ ਬਣਾਉਂਗੇ ਅਤੇ ਸਬਜ਼ੀਆਂ ਨੂੰ ਕੱਟਣ ਲਈ ਵੀ ਚਾਕੂ ਵਗੈਰਾ ਦੀ ਲੋੜ ਪੈਂਦੀ ਹੀ ਹੈ ਉਹਨਾਂ ਤੋਂ ਬਿਨਾਂ ਕੋਈ ਵੀ ਪਕਵਾਨ ਬਣਨਾ ਅਸੰਭਵ ਹੀ ਹੈ